ਪਹਿਤ ਸਾਡੇ ਜਿਹੜੇ ਧਾਰਮਿਕ ਤਿਉਹਾਰ ਹੈਗੇ ਹੈ ਉਹਨਾਂ ਨਾਲ ਸੰਬੰਧਿਤ ਬਹੁਤ ਸਾਰੇ ਖਾਣੇ ਬਣਾਏ ਜਾਂਦੇ ਹੈਗੇ ਹੈ ਉਹਨਾਂ ਵਿੱਚ ਜਿਹੜਾ ਸਭ ਤੋਂ ਮੇਨ ਖਾਣਾ ਹੁੰਦਾ ਹੈਗਾ ਜਿੱਦਾਂ ਹੁਣ ਮੰਨ ਲਓ ਸਾਡੇ ਜਿਹੜਾ ਕਿਤੇ ਵੀ ਅਖੰਡ ਪਾਠ ਸਾਹਿਬ ਜਾਂ ਕੋਈ ਵੀ ਤਿਉਹਾਰ ਆਉਂਦਾ ਹੈਗਾ ਸਭ ਤੋਂ ਪਹਿਲਾਂ ਤਾਂ ਉੱਥੇ ਦੇਗ ਬਣਾਈ ਜਾਂਦੀ ਹੈ ਗਈ ਹੈ ਦੇਗ ਦਾ ਭੋਗ ਲਵਾਇਆ ਜਾਂਦਾ ਹੈਗਾ ਏ ਦੇਗ ਸਾਡਾ ਪ੍ਰਮੁੱਖ ਖਾਣਾ ਹੈਗਾ ਏ ਉਹ ਤੋਂ ਬਾਅਦ ਜਦੋਂ ਲੰਗਰ ਚੱਲਦੇ ਹੈਗੇ ਹੈ ਉੱਥੇ ਜਿਹੜੀ ਦਾਲ ਬਣਾਈ ਜਾਂਦੀ ਹੈਗੀ ਹੈ ਉਹਨੂੰ ਉੱਥੇ ਲੰਗਰ ਦੀ ਦਾਲ ਵੀ ਕਿਹਾ ਜਾਂਦਾ ਹੈਗਾ ਹੈ ਦਾਲ ਫੁਲਕਾ ਵਗੈਰਾ ਵੀ ਚੱਲਦਾ ਹੈਗਾ ਏ ਉਹ ਤੋਂ ਇਲਾਵਾ ਜਿਦਾਂ ਲੰਗਰਾਂ ਵਿੱਚ ਸਾਡੇ ਉੱਥੇ ਦੁੱਧ ਵਗੈਰਾ ਵੀ ਚੱਲਦਾ ਹੁੰਦਾ ਹੈਗਾ ਏ ਦੁੱਧ ਚਾਹ ਵਗੈਰਾ ਵੀ ਚੱਲਦਾ ਰਹਿੰਦਾ ਹੈਗਾ ਏ